ਸ ਟੇਜ ਦਾ ਡਰ ਹਰ ਕਿਸੇ ਨੂੰ ਹੁੰਦਾ ਹੀ ਹੈ ਚਾਹੇ ਉਹ ਬਹੁਤ ਵੱਡਾ ਸਟਾਰ ਹੋਵੇ ਜਾਂ ਫਿਰ ਉਹ ਪੰਜ ਸਾਲਾਂ ਦਾ ਕੋਈ ਨਿੱਕਾ ਮੁੰਡਾ ਜਾਂ ਕੁੜੀ ਹੀ ਕਿਉਂ ਨਾ ਹੋਵੇ ਪਰ ਹਰ ਕੋਈ ਇਸ ਡਰ ਨੂੰ ਆਪਣੇ ਦਿਲੋਂ ਕੱਢ ਨਹੀਂ ਸਕਦਾ ਕਿਉਂਕਿ ਹਰ ਚੀਜ਼ ਦੇ ਲਈ ਇਕ ਤਕਨੀਕ ਦੀ ਲੋੜ ਹੁੰਦੀ ਹੈ ਪਰ ਹਰ ਕਿਸੇ ਕੋਲ ਤਕਨੀਕ ਹੁੰਦੀ ਨਹੀਂ ਬਚਪਨ ਵਿੱਚ ਜਦੋਂ ਮੈਂ ਅੱਠ ਸਾਲ ਅੱਠ ਸਾਲ ਦਾ ਸੀ ਮੇਰੇ ਪਿਤਾ ਜੀ ਨੇ ਮੈਨੂੰ ਰਾਮ ਲੀਲਾ ਦੇ ਸਟੇਜ ਉੱਤੇ ਖੜਾ ਕਰਤਾ ਅਤੇ ਕਿਹਾ ਗਾਣਾ ਸੁਣਾਓ ਮੈਂ ਉਦੋਂ ਵੀ ਗਾਉਂਦਾ ਹੁੰਦਾ ਜੀ ਮੇਰੀ ਆਵਾਜ਼ ਵੀ ਚੰਗੀ ਸੀ ਪਰ ਜਦੋਂ ਮੈਂ ਸਟੇਜ 'ਤੇ ਪਹਿਲੀ ਵਾਰ ਚੜਿਆ ਮੇਰੇ ਦਿਲ ਭਾਰੀ ਹੋ ਗਿਆ ਮੇਰੀਆਂ ਸਾਸਾਂ ਹੌਲੀ ਹੋ ਗਈਆਂ ਕਿਉਂਕਿ ਮੈਂ ਨਰਵਸ ਹੋ ਗਿਆ ਸੀ ਉਸ ਨਰਵਸਨੈਸ ਦੇ ਚਲਦੇ ਮੇਰੇ ਮੂੰਹੋਂ ਇੱਕ ਸ਼ਬਦ ਨਹੀਂ ਨਿਕਲਿਆ ਇੱਕ ਅੱਠ ਸਾਲਾਂ ਦਾ ਬੱਚਾ ਇੰਨੇ ਜ਼ਿਆਦਾ ਲੋਕਾਂ ਵਿੱਚ ਡਰ ਗਿਆ ਜੀ ਉਸ ਦਿਨ ਤਾਂ ਮੈਂ ਜ਼ਿਆਦਾ ਕੁਛ ਕੀਤੇ ਬਿਨਾ ਸਟੇਜ ਤੋਂ ਉਤਰ ਗਿਆ ਪਰ ਚਾਰ ਸਾਲ ਬਾਅਦ ਜਦੋਂ ਮੈਂ ਇੱਕ ਸਿੰਗਿੰਗ ਕੰਪਟੀਸ਼ਨ ਵਿਚ ਹਿੱਸਾ ਲਿੱਤਾ ਮੈਂ ਉੱਥੇ ਵੀ ਇਹੀ ਚੀਜ਼ ਫਿਰ ਤੋਂ ਮਹਿਸੂਸ ਕਰੀ ਪਰ ਇਸ ਵਾਰ ਹੋਇਆ ਇਹ ਕਿ ਮੈਂ ਗਾਉਣ ਤੋਂ ਪਹਿਲਾਂ ਮਜੀਸ਼ਨ ਨੂੰ ਧੰਨਵਾਦ ਕਰ ਰਿਹਾ ਸੀ ਕਿ ਤੁਸੀਂ ਸਾਡੀ ਆਵਾਜ਼ ਆਡੀਅਸ ਤੋ ਤੱਕ ਪਹੁੰਚਾਦੇ ਹੋ ਇਸ ਲਈ ਧੰਨਵਾਦ ਵਿੱਚ ਮੈਂ ਨਰਵਸਨੈਸ ਦੇ ਚਲਦੇ ਹੋਏ ਗਲਤ ਬੋਲਤਾ ਪਰ ਜਿਹੜਾ ਉੱਥੇ ਜੱਜ ਬੈਠਾ ਸੀ ਉਸ ਨੇ ਮਜੀਸ਼ਨ ਨੂੰ ਰੋਕਿਆ ਅਤੇ ਟੋਕਿਆ ਅਤੇ ਕਿਹਾ ਮਿਊਜਿਕ ਥੋੜ੍ਹਾ ਹੌਲੀ ਕਰੋ ਇਹਨਾਂ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ ਮੇਰੀ ਜਿੰਨੀ ਵੀ ਨਰਵਸਨੈਸ ਸੀ ਸਾਰੀ ਉਤਰ ਗਈ ਮੈਨੂੰ ਇੱਕ ਦੂਜਾ ਚਾਂਸ ਮਿਲਿਆ ਸੀ ਮੈਂ ਸਟੇਜ 'ਤੇ ਖੜ੍ਹੇ ਹੋ ਕੇ ਗਲਤ ਵਾਕ ਬੋਲ ਤਾ ਮਤਲਬ ਗਰਾਮੈਟੀਕਲੀ ਗਲਤ ਪਰ ਉਹ ਕਿਸੇ ਨੇ ਸੁਣਿਆ ਨਹੀਂ ਉਸ ਤੋਂ ਬਾਅਦ ਮੈਂ ਗਾਣਾ ਗਾਇਆ ਅਤੇ ਪੂਰੇ ਕੌਂਪਟੀਸ਼ਨ ਵਿੱਚ ਸੈਕਿੰਡ ਆਇਆ